ਮੈਂ ਸਭ ਤੋਂ ਪਹਿਲਾਂ ਘੋੜਸਵਾਰੀ ਲਈ ਇਸ ਲਈ ਆਕਰਸ਼ਿਤ ਹੋਇਆ ਸਭ ਤੋਂ ਪਹਿਲਾਂ ਮੈਂ ਇੱਕ ਵਾਰ ਉਹ ਘੋੜੇ ਦੀ ਜੋ ਕਿ ਸਵਾਰੀ ਕੀਤੀ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਘੋੜਾ ਇੱਕ ਇਹੋ ਜਿਹਾ ਤੇਜ਼ ਰਫਤਾਰ ਵਾਲਾ ਪਸ਼ੂ ਹੈ ਜਾਂ ਐਨੀਮਲ ਕਹਿ ਸਕਦੇ ਹਾਂ ਜਾਨਵਰ ਜਿਹੜਾ ਕਿ ਪੂਰਾ ਹਰ ਇਕ ਗੱਲ ਨੂੰ ਸਮਝਦਾ ਹੈ ਅਤੇ ਇਸ ਲਈ ਸਾਨੂੰ ਮੈਂ ਬਹੁਤ ਆਕਰਸ਼ਿਤ ਹੋਇਆ ਅਤੇ ਮੇਰਾ ਵੀ ਮਨ ਕਰਿਆ ਕਿ ਮੈਂ ਵੀ ਘੋੜਸਵਾਰੀ ਨੂੰ ਚੰਗੀ ਤਰ੍ਹਾਂ ਸਿੱਖਾਂ ਅਤੇ ਘੋੜਿਆਂ ਨਾਲ ਆਪਣਾ ਤਾਲਮੇਲ ਬਿਠਾਇਆ ਕਿਉਂਕਿ ਉਹ ਆਪਣੇ ਨਾਲ ਉਹਨਾਂ ਨਾਲ ਆਲ ਤਾਲਮੇਲ ਬਿਠਾਉਣਾ ਆਪਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਉਹ ਆਪਣੀ ਗੱਲਾਂ ਨੂੰ ਸਮਝ ਸਕਣ ਸੋ ਇਸ ਲਈ ਘੋੜਸਵਾਰੀ ਕਰਦੇ ਸਮੇਂ ਆਪਾਂ ਨੂੰ ਆਪਣੇ ਜਿਹੜੇ ਵੀ ਘੋੜੇ ਨਾਲ ਸਾਥੀ ਜਿੱਦਾਂ ਵਿਵਹਾਰ ਕਰਨਾ ਚਾਹੀਦਾ ਅਤੇ ਤਾਲਮੇਲ ਬਿਠਾਉਣਾ ਚਾਹੀਦਾ ਹੈ ਇਸ ਦਾ ਇਸ ਇਹ ਚੀਜ਼ਾਂ ਹੀ ਮੈਨੂੰ ਘੋੜ ਸਵਾਰੀ ਵੱਲ ਬਹੁਤ ਹੀ ਆਕਰਸ਼ਿਤ ਹੋਈਆਂ ਥੈਂਕ ਯੂ ਸੋ ਮਚ